ਸਰਫਿੰਗ ਖੇਡ ਸਰਫਿੰਗ ਖੇਡ ਜਿਹੜੀ ਆ ਔਲਰੇਡੀ ਬਹੁਤ ਮਸ਼ਹੂਰ ਹੈ ਹਰ ਬੰਦਾ ਨੌਲੇਜ ਰੱਖਦਾ ਇਹਦੇ ਬਾਰੇ ਹਾਂ ਪਹਿਲਾਂ ਇੰਨੀ ਪ੍ਰਚਲਿਤ ਤਾਂ ਨਹੀਂ ਸੀ ਪਰ ਖੇਡੀ ਜਾਂਦੀ ਸੀ ਪਰ ਲੋਕਾਂ ਦਾ ਇੰਟਰਸਟ ਵੀ ਹੈ ਸੀ ਕਿ ਕਿਵੇਂ ਖੇਡੀ ਜਾਂਦੀ ਇਹ ਬੰਦਾ ਕਿਵੇਂ ਕਰ ਲੈਂਦਾ ਬਟ ਹੁਣ ਇਹਨਾਂ ਦੇ ਅਲੱਗ ਅਲੱਗ ਸੈਂਟਰ ਬਣਨ ਨਾਲ ਟ੍ਰੇਨਿੰਗ ਸੈਂਟਰ ਬਣਨ ਨਾਲ ਜਾਂ ਇਹਨਾਂ ਦਾ ਬੋਰਡ ਬਣਨ ਨਾਲ ਜਿਹੜਾ ਕਿ ਇਹਨਾਂ ਨੂੰ ਕਿਸੇ ਨਾ ਕਿਸੇ ਲੈਵਲ 'ਤੇ ਹਰ ਲੈਵਲ ਦੇ ਉੱਤੇ ਜਾ ਕੇ ਹਰ ਖਿਡਾਰੀ ਨੂੰ ਸਪੋਰਟ ਵੀ ਕਰਦਾ ਔਰ ਇਸਦੀ ਐਡ ਇੰਨੀ ਹੋ ਜਾਂਦੀ ਹੈ ਜਿਵੇਂ ਕਈ ਮੰਚ ਬਣ ਚੁੱਕੇ ਨੇ ਜਿਵੇਂ ਯੂਟੀਊਬ ਹੈ ਜਾਂ ਹੋਰ ਸਪੋਰਟਸ ਚੈਨਲ ਹੁੰਦੇ ਆ ਜਿਹਨਾਂ ਦੇ ਵਿੱਚ ਇਹਦੀ ਕਾਫੀ ਐਡ ਕੀਤੀ ਜਾਂਦੀ ਹੈ ਔਰ ਉਹ ਐਡ ਹੋਣ ਨਾਲ ਹਰ ਖਿਡਾਰੀ ਤੱਕ ਜਾਂ ਹਰ ਆਮ ਆਦਮੀ ਤੱਕ ਇਹ ਚੀਜ਼ਾਂ ਜਦੋਂ ਪਹੁੰਚਦੀਆਂ ਨੇ ਨਾ ਤਾਂ ਖਿਡਾਰੀ ਜਿਹੜਾ ਨਾ ਉਹ ਇਹਨਾਂ ਚੀਜ਼ਾਂ ਨੂੰ ਬਿਜ਼ਨਸ ਲੈਵਲ 'ਤੇ ਵੀ ਲੈ ਜਾਂਦਾ ਮਤਲਬ ਪਹਿਲਾਂ ਹੋਬੀ ਹੁੰਦੀ ਸੀ ਇੱਕ ਹੋਬੀ ਇੱਕ ਆਦਤ ਨੂੰ ਪੂਰੀ ਕਰਨ ਲਈ ਬੰਦਾ ਖੇਡਦਾ ਸੀ ਬਟ ਜਦੋਂ ਉਸਨੂੰ ਬਿਜਨਸ ਬਣਾਉਂਦਾ ਤਾਂ ਉਹ ਰੈਗੂਲਰ ਹੋ ਜਾਂਦਾ ਔਰ ਬਿਜਨਸ ਬਣਨ ਦਾ ਰੀਜ਼ਨ ਇਹੀ ਹੈ ਕਿ ਇਹਦੀਆਂ ਜਿਹੜੀਆਂ ਚੀਜ਼ਾਂ ਨੇ ਇਹਦੀਆਂ ਜਿਹੜੀਆਂ ਗੇਮਸ ਦੇ ਪ੍ਰੋਡਕਟ ਨੇ ਉਹ ਕਾਫੀ ਵਧੀਆ ਅਤੇ ਲਾਈਟਵੇਟ ਹੋਣ ਕਰਕੇ ਵੀ ਹਰ ਬੰਦਾ ਇਹਨਾਂ ਨੂੰ ਨੋਰਮਲ ਤਰੀਕੇ ਨਾਲ ਯੂਜ਼ ਕਰ ਲੈਂਦਾ ਔਰ ਕਾਫੀ ਐਡ ਹੋ ਗਈ ਤੁਸੀਂ ਦੇਖੋ ਦੋ ਹਜ਼ਾਰ ਵੀਹ ਦੇ ਵਿੱਚ ਇਸ ਨੂੰ ਓਲੰਪਿਕ ਖੇਡਾਂ ਦੇ ਵਿੱਚ ਸ਼ਾਮਿਲ ਵੀ ਕਰ ਲਿਆ ਗਿਆ ਸੀ ਔਰ ਜਦੋਂ ਓਲੰਪਿਕ ਖੇਡਾਂ ਦੇ ਵਿੱਚ ਸ਼ਾਮਿਲ ਹੋ ਗਈਆਂ ਗੇਮ ਕੋਈ ਵੀ ਹੋਵੇ ਤਾਂ ਉਹ ਕਿੰਨਾ ਬਿਜ਼ਨਸ ਕਰਦੀ ਹੈ ਜਾਂ ਕਿੰਨਾ ਕਿੰਨੀ ਗਰੋਥ ਕਰਦੀ ਹੈ ਇਹ ਤੁਸੀਂ ਆਪ ਹੀ ਸੋਚ ਸਕਦੇ ਹੋ ਇਸ ਗੇਮ ਨੇ ਕੁਛ ਟਾਈਮ ਦੇ ਵਿੱਚ ਹੀ ਮਤਲਬ ਜਦੋਂ ਇਹਨੂੰ ਓਲੰਪਿਕ ਦੇ ਵਿੱਚ ਖੇਡਿਆ ਗਿਆ ਤਾਂ ਇਹ ਕਾਫੀ ਇਸਦੀ ਐਡ ਵੀ ਹੋ ਗਈ ਮਸ਼ਹੂਰੀ ਵੀ ਹੋ ਗਈ ਔਰ ਤਕਰੀਬਨ ਲੋਕਾਂ ਨੇ ਇਸ ਨੂੰ ਬਿਜ਼ਨਸ ਲੈਵਲ 'ਤੇ ਵੀ ਬਣਾਉਣਾ ਸ਼ੁਰੂ ਕੀਤਾ ਹੁਣ ਹਰ ਬੰਦਾ ਇਸ ਨੂੰ ਖੇਡਣ ਦਾ ਇੱਛੁਕ ਹੁੰਦਾ ਔਰ ਹਰ ਬੰਦਾ ਟਰਾਈ ਇੱਥੋਂ ਤੱਕ ਬੱਚੇ ਵੀ ਟਾਰਾਈ ਕਰਨ ਲੱਗ ਪਏ ਨੇ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਮਤਲਬ ਸੱਤ ਅੱਠ ਸਾਲ ਦੇ ਤੋਂ ਬਾਅਦ ਹੀ ਉਹ ਦਸ ਸਾਲ ਤੋਂ ਬਾਅਦ ਜਦੋਂ ਤੋਰਨ ਲਾਇਕ ਹੁੰਦਾ ਤਾਂ ਕੋਸ਼ਿਸ਼ ਕਰਨ ਲੱਗ ਜਾਂਦਾ ਫੋਰਨ ਕੰਟਰੀਆਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਇਸ ਨੂੰ ਯੂਜ਼ ਕਰ ਰਹੇ ਨੇ ਤਾਂ ਕਾਫੀ ਅੱਛੀ ਅਤੇ ਵਿਕਸਿਤ ਗੇਮ ਹੋ ਚੁੱਕੀ ਹੈ ਬਹੁਤ ਵਧੀਆ